ਅਸੀਂ ਇੱਕ ਵਾਰ ਬੈਂਕ ਤੋਂ ਕਰਜ਼ਾ ਲਿਆ ਜਿਸ ਅਤੇ ਸਾਡੀ ਬਹੁਤ ਜ਼ਿਆਦਾ ਭਕਾਈ ਕਰਾਈ ਗਈ ਕਦੇ ਸਾਥੋਂ ਡਾਕੂਮੈਂਟ ਕੋਈ ਮੰਗਣ ਅਤੇ ਕਦੇ ਬਹੁਤ ਜ਼ਿਆਦਾ ਗੇੜੇ ਮਰਵਾਏ ਤੁਹਾਡਾ ਬੈਂਕ ਵਾਲੇ ਕਿਹਾ ਕਰਨ ਅੱਜ ਨਹੀਂ ਲੋਨ ਹੋਣ ਕਰਜਾ ਮਿਲਣਾ ਕੱਲ੍ਹ ਨੂੰ ਆ ਜਾਣਾ ਇਸ ਤਰ੍ਹਾਂ ਕਹਿ ਕਹਿ ਕੇ ਸਾਡੇ ਬਹੁਤ ਜ਼ਿਆਦਾ ਗੇੜੇ ਮਰਵਾਏ ਜਿਸ ਤੋਂ ਅਸੀਂ ਬਹੁਤ ਜ਼ਿਆਦਾ ਅੱਕ ਗਏ ਸੀ ਪਰ ਮਜਬੂਰੀ ਕਾਰਨ ਅਸੀਂ ਉਹਨਾਂ ਬੈਂਕਾਂ ਵਿੱਚ ਗੇੜੇ ਲਾਉਂਦੇ ਰਹੇ ਅਤੇ ਗੋਲਡ 'ਤੇ ਲੋਨ ਲਿਆ ਅਸੀਂ ਜਿਸ ਕਰਕੇ ਉਹਨਾਂ ਦਾ ਵਿਓ ਵਿਆਜ ਵੀ ਬਹੁਤ ਜ਼ਿਆਦਾ ਸੀ ਸਾਨੂੰ ਭਰਨ ਵਿੱਚ ਬਹੁਤ ਮੁਸ਼ਕਿਲ ਆਈ ਇਸ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਸੌਖਾ ਕਰਨਾ ਚਾਹੀਦਾ ਹੈ ਤਾਂ ਜੋ ਗਰੀਬ ਬੰਦਾ ਆਸਾਨੀ ਨਾਲ ਲੋਨ ਲੈ ਸਕੇ ਇਸ 'ਤੇ ਡਾਕੂਮੈਂਟ ਵੀ ਘੱਟ ਲੱਗਣੇ ਚਾਹੀਦੇ ਹਨ ਅਤੇ ਵਿਆਜ ਵੀ ਬਹੁਤ ਘੱਟ ਹੋਣਾ ਚਾਹੀਦਾ ਹੈ ਤਾਂ ਜੋ ਗਰੀਬ ਬੰਦਾ ਆਸਾਨੀ ਨਾਲ ਬੈਂਕ ਦਾ ਕਰਜ਼ਾ ਉਤਾਰ ਸਕੇ ਅਤੇ ਥੋੜ੍ਹੀ ਬਹੁਤ ਹੀ ਕਿਸ਼ਤ ਬਣਨੀ ਚਾਹੀਦੀ ਹੈ ਤਾਂ ਜੋ ਬੰਦਾ ਕਿਸ਼ਤਾਂ ਨਾਲ ਹੀ ਬੈਂਕ ਦਾ ਕਰਜ਼ਾ ਲਾਹ ਸਕੇ ਇਕ ਇਕੱਠਾ ਬੈਂਕ ਦਾ ਕਰਜ਼ਾ ਲਾਉਣਾ ਬਹੁਤ ਔਖਾ ਹੁੰਦਾ ਹੈ ਇਸ ਲਈ ਥੋੜ੍ਹਾ ਬਹੁਤਾ ਧਿਆਨ ਦਿੱਤਾ ਜਾਵੇ ਤਾਂ ਜੋ ਹਰ ਕੋਈ ਬੰਦਾ ਕਰਜ਼ਾ ਲੈ ਸਕੇ ਅਤੇ ਇੱਕ ਅੱਧੇ ਡਾਕੂਮੈਂਟ